ਭੰਗੜਾ ਐਰੋਬਿਕ ਇੱਕ ਲੋਕ ਨਾਚ ਹੈ ਜਿਸ ਤਰ੍ਹਾਂ ਹਰ ਇੱਕ ਮੁਲਕ ਦਾ ਹਰ ਇੱਕ ਸ਼ਹਿਰ ਦਾ ਨਾਚ ਹੁੰਦੇ ਹਨ ਲੋਕ ਨਾਚ ਹੁੰਦੇ ਹਨ ਇਸੇ ਤਰ੍ਹਾਂ ਭੰਗੜਾ ਵੀ ਜੋ ਹੈ ਉਹ ਪੰਜਾਬ ਦਾ ਲੋਕ ਨਾਚ ਹੈ ਅਤੇ ਭੰਗੜਾ ਜੋ ਹੈ ਪੰਜਾਬ ਦੀ ਪਹਿਚਾਣ ਹੈ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਿੱਥੇ ਇੰਨਾ ਕੁ ਜ਼ਮਾਨਾ ਅੱਗੇ ਨਿਕਲ ਗਿਆ ਹੈ ਬਾਹਰਲੇ ਮੁਲਕਾਂ ਦੇ ਉਹ ਸਾਰੇ ਰਹਿਣ ਸਹਿਣ ਤਰੀਕੇ ਅਪਣਾ ਰਿਹਾ ਹੈ ਹੋਰ ਵੱਖ ਵੱਖ ਨਾਚ ਸਿੱਖ ਰਿਹਾ ਹੈ ਉੱਥੇ ਭੰਗੜਾ ਜੋ ਹੈ ਉਹ ਆਪਣੀ ਜਿਹੜੀ ਪਹਿਚਾਣ ਅੱਗੇ ਸੀ ਉਹ ਵਾਪਸ ਹੌਲੀ ਹੌਲੀ ਲਿਆ ਰਿਹਾ ਹੈ ਦੇਖਣ ਨੂੰ ਇਹ ਵੀ ਆਇਆ ਹੈ ਕਿ ਜਿਹੜੇ ਵਿਦੇਸ਼ੀ ਮੁਲਖ ਹਨ ਉਨ੍ਹਾਂ ਵਿੱਚ ਵੀ ਲੋਕ ਨਾਚ ਦੇ ਤੋਰ 'ਤੇ ਭੰਗੜੇ ਦੇ ਵੱਖਰੇ ਵੱਖਰੇ ਅਲੱਗ ਅਲੱਗ ਕੰਪੀਟੀਸ਼ਨ ਕਰਾਏ ਜਾਂਦੇ ਹਨ ਅਤੇ ਬਹੁਤ ਸਾਰੇ ਵਿਦਿਆਰਥੀ ਬਹੁਤ ਸਾਰੇ ਨੌਜਵਾਨ ਜਿਹੜੇ ਹਨ ਉਹ ਇਸ ਭੰਗੜਾ ਐਰੋਬਿਕਸ ਵਿੱਚ ਬਹੁਤ ਦਿਲਚਸਪੀ ਵੀ ਦਿਖਾ ਰਹੇ ਹਨ ਕਾਰਨ ਇਸਦਾ ਇੱਕ ਇਹੀ ਮੁੱਖ ਕਾਰਨ ਹੈ ਕਿ ਪਹਿਲਾਂ ਸਾਡੇ ਲੋਕ ਨਾਚ ਵਿੱਚ ਜਦੋਂ ਭੰਗੜਾ ਹੁੰਦਾ ਸੀ ਸਾਰੇ ਹੀ ਨੌਜਵਾਨ ਉਨ੍ਹਾਂ ਨਾਲ ਜੁੜੇ ਰਹਿੰਦੇ ਸੀ ਪਰ ਅੱਜ ਕੱਲ੍ਹ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਇੰਨੀ ਕੁ ਮਤਲਬ ਵਿਅਸਤ ਹੋ ਚੁੱਕੀ ਹੈ ਕਿ ਲੋਕਾਂ ਨੂੰ ਆਪਣੇ ਮਨੋਰੰਜਨ ਲਈ ਜਿਹੜਾ ਸਮਾਂ ਹੈ ਉਹ ਕੱਢਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਰਕੇ ਜਿਹੜੇ ਮਨੁੱਖ ਨੇ ਉਹ ਇਨ੍ਹਾਂ ਰੂਚੀਆਂ ਵੱਲ ਨੂੰ ਜਾਣਾ ਪਸੰਦ ਕਰਦੇ ਹਨ ਅਤੇ ਜਿਹੜੇ ਮਨੁੱਖ ਇਨ੍ਹਾਂ ਨੂੰ ਸਿੱਖ ਦੇ ਹਨ ਉਨ੍ਹਾਂ ਦੀ ਮਰਜ਼ੀ ਵੀ ਉਨ੍ਹਾਂ ਦੀ ਜਿਹੜੀ ਸੋਚਣੀ ਉਹ ਵੀ ਇਹ ਹੋ ਜਾਂਦੀ ਹੈ ਕਿ ਜਦੋਂ ਆਪਾਂ ਇਹੋ ਤਰ੍ਹਾਂ ਦੇ ਲੋਕ ਨਾਚਾਂ ਨੂੰ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਹੀ ਹਲਕਾ ਬਹੁਤ ਹੀ ਚੰਗਾ ਮਹਿਸੂਸ ਕਰਦੇ ਹਾਂ ਜਿਹੜੀ ਮਾਨਸਿਕ ਸਥਿਤੀ ਕੋਈ ਤਣਾਅ ਵਿੱਚ ਹੁੰਦਾ ਹੈ ਕੋਈ ਬਹੁਤ ਹੀ ਨਾਕਰਾਤਮਕ ਸੋਚ ਰੱਖਦਾ ਹੈ ਇਹੋ ਜਿਹੇ ਮਨੁੱਖ ਜਿਹੜੇ ਹਨ ਭੰਗੜੇ ਵਰਗੇ ਲੋਕ ਨਾਚ ਕਰਕੇ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰਦੇ ਹਨ ਅਤੇ ਇੱਕ ਫਾਇਦਾ ਇਸ ਭੰਗੜੇ ਦਾ ਇਹ ਵੀ ਹੈ ਕਿ ਅੱਜ ਕੱਲ੍ਹ ਦਾ ਨੌਜਵਾਨ ਪੀੜ੍ਹੀ ਜਿਨ੍ਹਾਂ ਨੂੰ ਬਿਲਕੁਲ ਹੀ ਆਪਣੇ ਵਿਰਸੇ ਨਾਲ ਕੋਈ ਲੈਅ ਵਾਸਤਾ ਨਹੀਂ ਉਨ੍ਹਾਂ ਨੂੰ ਕੋਈ ਬਿਲਕੁਲ ਜਾਣਕਾਰੀ ਨਹੀਂ ਹੈ ਭੰਗੜਾ ਐਰੋਬਿਕਸ ਜੋ ਹੈ ਉਹ ਮਦਦ ਕਰਦਾ ਹੈ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣ ਨਾਲ ਨਾਲ ਜੁੜੇ ਰਹਿਣ ਨਿੱਕੇ ਹੁੰਦਿਆਂ ਹੀ ਸੁਣਿਆ ਆਇਆ ਸੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਇਹ ਕਹਾਵਤ ਨੂੰ ਸੁਣਦਿਆਂ ਲਾਹੌਰ ਸ਼ਹਿਰ ਨੂੰ ਦੇਖਣ ਦੀ ਤਾਂਘ ਹਮੇਸ਼ਾ ਹੀ ਦਿਲ ਵਿੱਚ ਰਹੀ ਪਿਛਲੇ ਦਿਨੀਂ ਪੈਂਤੀਵੀਂ ਵਿਸ਼ਵ ਪੰਜਾਬੀ ਕੋਨਫਰੰਸ ਵਿੱਚ ਹਿੱਸਾ ਲੈਣ ਦੇ ਬਹਾਨੇ ਲਾਹੌਰ ਜਾਣ ਦਾ ਸਬੱਬ ਬਣਿਆ ਮੇਰੀ ਚੌਦਵੀਂ ਪੁਸਤਕ ਪੰਜ ਆਬ ਦੇ ਸ਼ਾਹ ਅਸਵਾਰ ਦਾ ਰਿਲੀਜ ਸਮਾਰੋਹ ਵੀ ਲਾਹੌਰ ਹੀ ਰੱਖਿਆ ਗਿਆ ਸੀ ਰਾਜ ਦੀ ਰਾਜਧਾਨੀ ਅਤੇ ਅਜ਼ਾਦੀ ਦੀ ਲਹਿਰ ਨਾਲ ਜੁੜੀਆਂ ਅਨੇਕਾਂ ਇਤਿਹਾਸਿਕ ਥਾਂਵਾਂ ਲਾਹੌਰ ਵਿੱਚੋਂ ਮੌਜੂਦ ਹਨ ਜੋ ਭਾਰਤ ਖਾਸ ਕਰਕੇ ਪੰਜਾਬ ਤੋਂ ਗਏ ਸੈਲਾਨੀਆਂ ਲਈ ਖਿੱਚ ਦਾ ਮੁੱਖ ਕੇਂਦਰ ਹੁੰਦੀਆਂ ਹਨ ਲਾਹੌਰ ਨੇ ਸ਼ਾਹੀ ਕਿਲੇ ਕੋਲ ਗੁਰਦੁਆਰਾ ਡੇਰਾ ਸਾਹਿਬ ਹੈ ਜਿੱਥੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਅਰਜਨ ਦੇਵ ਜੀ ਨੇ ਸ਼ਹਾਦਤ ਦਿੱਤੀ ਸੀ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਜੀ ਸਥਿਤ ਹਨ ਜਿੱਥੇ ਭਾਰਤ ਤੋਂ ਆਈਆਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਇਸ ਤੋਂ ਇਲਾਵਾ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ ਦਰਗਾਹ

ਸ਼ਾਹੀ ਕਿਲੇ ਨੇ ਅਤੇ ਨਾਲ ਮੀਨਾਰ ਏ ਪਾਕਿਸਤਾਨ ਸਥਿਤ ਹੈ ਲਾਹੌਰ ਦਾ ਖਾਣਾ ਅਤੇ ਪਹਿਰਾਵਾ ਦੋਵੇਂ ਮਸ਼ਹੂਰ ਹਨ ਲਾਹੌਰ ਸ਼ਹਿਰ ਪੂਰੀ ਰਾਤ ਸੌਂਦਾ ਨਹੀਂ